ਪੰਜਾਬ ਵਿੱਚ ਕੁਝ ਖਾਸ ਤਿਉਹਾਰ ਜਾਂ ਸਮਾਗਮ ਇਸ ਤਰ੍ਹਾਂ ਹਨ ਜਿਨ੍ਹਾਂ ਉੱਤੇ ਪੰਜਾਬੀ ਬਹੁਤ ਨੱਚਦੇ ਹਨ ਖਾਸ ਕਰ ਵਿਆਹ ਵੇਲੇ ਬੁੜੀਆਂ ਅਤੇ ਮੁਟਿਆਰਾਂ ਗਾਉਣ ਗਾਉਂਦੀਆਂ ਹਨ ਅਤੇ ਨਾਲ ਗਿੱਧਾ ਪਾਉਂਦੀਆਂ ਹਨ ਵਿਆਹ ਭਾਵੇਂ ਕੁੜੀ ਦਾ ਹੋਵੇ ਜਾਂ ਮੁੰਡੇ ਦਾ ਦਾਦਕਿਆਂ ਅਤੇ ਨਾਨਕਿਆਂ ਇੱਕ ਦੂਜੇ ਨੂੰ ਮਿਲ ਕੇ ਸਿੱਠਣੀਆਂ ਦਿੰਦੀਆਂ ਹਨ ਵਿਸਾਖੀ ਦੇ ਵੇਲੇ ਆਪਣੀ ਫਸਲ ਪੱਕਣ ਦੀ ਖੁਸ਼ੀ ਵਿੱਚ ਪੰਜਾਬੀ ਲੋਕ ਗਿੱਧਾ ਜਾਂ ਭੰਗੜਾ ਜ਼ਰੂਰ ਪਾਉਂਦੇ ਹਨ ਇਸ ਤੋਂ ਇਲਾਵਾ ਪੰਜਾਬੀ ਲੋਕ ਸਾਉਣ ਦੀਆਂ ਤੀਆਂ 'ਤੇ ਨੱਚਦੇ ਹਨ